ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਫਲਿੱਪਕਰਟ ਦਫਤਰ ਤੋਂ ਗੱਲ ਕਰ ਰਹੇ ਮੈਂ ਬਰਿੰਦਰ ਸਿੰਘ ਗੱਲ ਕਰ ਰਿਹਾ ਅਤੇ ਮੇਰਾ ਪਤਾ ਕਪੂਰਥਲਾ ਜ਼ਿਲ੍ਹੇ ਤੋਂ ਗੱਲ ਕਰ ਰਿਹਾ ਅਤੇ ਮੈਂ ਤੁਹਾਡੇ ਕਾਰਡ ਵਿੱਚ ਇੱਕ ਹੈਡਫੋਨ ਦੀ ਜੋੜੀ ਓਡਰ ਕਰਨੀ ਸੀ ਅਤੇ ਕਾਰਡ ਵਿੱਚ ਮੈਂ ਗਲਤੀ ਨਾਲ ਹੋਰ ਹੈਡਫੋਨ ਜੋੜ ਲਏ ਹਨ ਅਤੇ ਉਸ ਮੈਂ ਜੋੜੀ ਨੂੰ ਉਹਨੂੰ ਹਟਾਉਣਾ ਚਾਹੁੰਦਾ ਹਾਂ ਤਾਂ ਜੇ ਮੈਂ ਹੋਰ ਹੈਡਫੋਨ ਓਡਰ ਕਰ ਸਕਾਂ ਇਸ ਲਈ ਮੇਰੇ ਪੁਰਾਣੇ ਜੋੜੇ ਹੋਏ ਹੈਡਫੋਨ ਹੈ ਕਾਰਡ ਵਿੱਚ ਉਹਨੂੰ ਕੱਟੇ ਜਾਣ ਅਤੇ ਮੈਂ ਨਵੀਂ ਪ੍ਰਕਿਰਿਆ ਸ਼ੁਰੂ ਕਰ ਸਕਾਂ ਅਤੇ ਅਤੇ ਮੈਨੂੰ ਚੈੱਕ ਕਰਕੇ ਦੱਸ ਦਿੱਤਾ ਜਾਵੇ ਕਿ ਤੁਸੀਂ ਮੇਰੀ ਜੋੜੀ ਉਹ ਕਾਰਡ ਤੋਂ ਹਟਾ ਦਿੱਤੀ ਹੈ ਠੀਕ ਹੈ ਜੀ ਧੰਨਵਾਦ ਜੀ